ਹਾਲ ਹੀ ਵਿੱਚ ਮੈਂ ਤੁਹਾਡੀ ਦੁਕਾਨ ਤੋਂ ਇੱਕ ਫੋਨ ਲਿਆ ਸੀ ਸ਼ੁਰੂਆਤ ਦੇ ਦਿਨਾਂ ਵਿੱਚ ਤਾਂ ਉਹ ਬਹੁਤ ਚੰਗਾ ਚੱਲ ਰਿਹਾ ਸੀ ਪਰ ਕੁਛ ਦਿਨਾਂ ਬਾਅਦ ਉਹ ਰੁਕ ਰੁਕ ਕੇ ਚਲਣਾ ਸ਼ੁਰੂ ਹੋ ਗਿਆ ਉਹ ਮੈਨੂੰ ਬਹੁਤ ਤਕਲੀਫ਼ ਦੇ ਰਿਹਾ ਹੈ ਕਿਉਂਕਿ ਨਾ ਤਾਂ ਮੈਂ ਕਿਸੇ ਨਾਲ ਚੱਜ ਨਾਲ ਗੱਲ ਪਰ ਕਰ ਪਾ ਰਿਹਾ ਹਾਂ ਨਾ ਹੀ ਮੈਂ ਕਿਸੇ ਦੀ ਕਾਲ ਚੰਗੀ ਤਰ੍ਹਾਂ ਨਾਲ ਸੁਣ ਪਾ ਰਿਹਾ ਹਾਂ ਉਹਦੀ ਟਚ ਵੀ ਬਹੁਤ ਹੀ ਘਟੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਉਹਦੇ ਐਪਸ ਵੀ ਰੁਕ ਰੁਕ ਕੇ ਚੱਲ ਰਹੇ ਹਨ ਮੈਂ ਕੋਈ ਗਾਣਾ ਵੀ ਜੇ ਸੁਣਦਾ ਹਾਂ ਤਾਂ ਵੀ ਮੈਨੂੰ ਉਹ ਚੰਗੀ ਤਰ੍ਹਾਂ ਨਾਲ ਨਹੀਂ ਸੁਣਾਈ ਦੇ ਰਿਹਾ